ਸਤਿ ਸ਼੍ਰੀ ਅਕਾਲ ਮੈਮ ਫੇਰ ਪੰਜਾਬੀ ਗਾਰਮੈਂਟਸ ਤੋਂ ਬੋਲ ਰਹੇ ਹੋ ਹਾਂਜੀ ਮੈਮ ਸਾਡੇ ਨਾ ਪਰਸੋਂ ਲਈ ਸਾਡੇ ਫੰਕਸ਼ਨ ਹੈ ਔਰ ਸਾਨੂੰ ਕੁਛ ਟਰਡੀਸ਼ਨਲ ਡਰੈਸਿਸ ਚਾਹੀਦੀਆਂ ਸੀ ਹਾਂਜੀ ਹਾਂਜੀ ਦੋਨਾਂ ਲਈ ਹਾਂਜੀ ਅਤੇ ਮੁੰਡੇ ਹਾਂ

ਹਾਂਜੀ ਠੀਕ ਹੈ ਠੀਕ ਹੈ ਅੱਛਾ ਠੀਕ ਹੈ ਅਤੇ ਸਾਨੂੰ ਹਾਂ ਹਾਂਜੀ ਸਾਨੂੰ ਸਾਰੀਆਂ ਡਰੈਸਸ ਅਲੱਗ ਅਲੱਗ ਕਲਰ ਦੀਆਂ ਚਾਹੀਦੀਆਂ ਨੇ ਅੱਛਾ ਜੀ ਹਾਂਜੀ ਮੈਂ ਹਾਂਜੀ ਨਹੀਂ ਮੈਮ ਅਸੀਂ ਨਾ ਕੱਲ ਇੱਥੇ ਤੁਹਾਡੇ ਕੋਲ ਆ ਕੇ ਹੀ ਲੈ ਕੇ ਜਾਵਾਂਗੇ ਹਾਂਜੀ ਅਤੇ ਸਾਨੂੰ ਹਾਂਜੀ ਸਾਨੂੰ ਛੇ ਛੇ ਮਤਲਬ ਪਰਸਨ ਲਈ ਚਾਹੀਦੀਆਂ ਨੇ ਛੇ ਮੁੰਡਿਆਂ ਔਰ ਛੇ ਕੁੜੀਆਂ ਲਈ ਇਸੇ ਐਡਰੈਸ 'ਤੇ

ਠੀਕ ਹੈ ਠੀਕ ਹੈ ਮੈਮ ਠੀਕ ਹੈ ਜੀ ਚੱਲੋ ਮੈਮ ਅਸੀਂ ਕੱਲ ਕੱਲ ਆਉਂਦੇ ਹਾਂ ਫਿਰ ਓਕੇ ਮੈਮ ਓ ਓਕੇ ਮੈਮ ਥੈਂਕ ਯੂ